ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਬੋਲਦੇ ਹਾਂ ਜੀ ਤੁਸੀਂ ਕੌਣ ਬੋਲਦੇ ਹੋ ਹਾਂਜੀ ਹਾਂਜੀ ਅੱਛਾ ਜੀ

ਅੱਛਾ ਜੀ ਅੱਛਾ ਅੱਛਾ ਹਾਂਜੀ ਹਾਂਜੀ ਪਲੀ ਅੱਛਾ ਜੀ ਉਹ ਨਾ ਵੀਰ ਜੀ ਇਸ ਤਰ੍ਹਾਂ ਇੱਕ ਨਾ ਅਸੀਂ ਬਰਨਾਲੇ ਪ੍ਰੀ ਵੈਡਿੰਗ ਸ਼ੂਟ ਵਾਸਤੇ ਪੂਰਾ ਵਧੀਆ ਬਣਾਇਆ ਹੋਇਆ ਮੰਚ ਆਪਣਾ ਉਹ ਦੇ ਵਿੱਚ ਅਸੀਂ ਦੇਖੋ ਵੋਟਿੰਗ ਦੀ ਫੋਟੋਗ੍ਰਾਫੀ ਵੀ ਕਰਦੇ ਹਾਂ ਅਸੀਂ ਘੋੜੇ 'ਤੇ ਬਿਠਾ ਕੇ ਫੋਟੋਗ੍ਰਾਫੀ ਵੀ ਕਰਦੇ ਹਾਂ ਅਸੀਂ ਮੋਟਰਸਾਈਕਲ ਵਗੈਰਾ ਜਿਹੜੇ ਪੁਰਾਣੇ ਪਹਿਲਾਂ ਚੱਲਦੇ ਸੀ ਫੀਐਟ ਗੱਡੀਆਂ ਉਹਨਾਂ 'ਤੇ ਵੀ ਕਰਵਾਉਂਦੇ ਹਾਂ ਅਤੇ ਬਸ ਤੁਸੀਂ ਦੇਖ ਕੇ ਕਮਾਲ ਮੰਨ ਜਾਓਗੇ ਜੀ ਸਾਡੇ ਤੋਂ ਤਾਂ ਹੁਣ ਬਹੁਤ ਸਾਡੇ ਕੋਲ ਇੰਨੀ ਬੁਕਿੰਗ ਹੈ ਜੀ ਮੈਨੂੰ ਲੱਗਦਾ ਅਕਤੂਬਰ ਦੀ ਤੁਹਾਨੂੰ ਪਹਿਲਾਂ ਤਾਰੀਕ ਪੁੱਛ ਕੇ ਮੈਨੂੰ ਦੇਖਣਾ ਪਊ ਵੀ ਉਸ ਦਿਨ ਦਾ ਸਾਡੇ ਕੋਲ ਟਾਈਮ ਹੈ ਕਿ ਨਹੀਂ ਹੈ ਵੈਸੇ ਬਹੁਤ ਜ਼ਿਆਦਾ ਬੁਕਿੰਗ ਚੱਲ ਰਹੀ ਆ ਹੁਣ ਕਿਉਂਕਿ ਵਿਆਹਾਂ ਦਾ ਸੀਜਨ ਆ ਰਿਹਾ ਨਾ ਜੀ ਅਤੇ ਬਸ ਤੁਸੀਂ ਇੱਕ ਇੱਕ ਵਾਰੀ ਪ੍ਰੀ ਵੈਡਿੰਗ ਸ਼ੂਟ ਕਰਵਾ ਕੇ ਦੇਖੋ ਜੀ ਤੁਸੀਂ ਲੋਕ ਬਸ ਉਹੀ ਉੱਥੋਂ ਦੇਖੀ ਜਾਣਗੇ ਮੰਗਵਾ ਮੰਗਵਾ ਕੇ ਵੀ ਕਿੱਥੋਂ ਕਰਵਾਈ ਹੈ ਇਹ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਉਹ ਆਪਣਾ ਹੀ ਬਣਾਇਆ ਵਾ ਜੀ ਸਾਰਾ ਅਸੀਂ ਇਸੇ ਵਾਸਤੇ ਹੀ ਕਿੱਲਾ ਜਮੀਨ ਦਾ ਇਸ ਵਾਸਤੇ ਰੱਖਿਆ ਸੀ ਪਹਿਲਾਂ ਪਹਿਲਾਂ ਤੋਂ ਹੀ ਪਲਾਨ ਨਾਲ ਹੀ ਕੰਮ ਕਰਾਇਆ ਸੀ ਹਾਂਜੀ ਹਾਂਜੀ ਹਾਂਜੀ ਉਹ ਪੁਰਾਣੇ ਜਿਵੇਂ ਐਸ ਟੀ ਡੀ ਪੀ ਸੀ ਓ ਤੋਂ ਫੋਨ ਵਗੈਰਾ ਕਰਦੇ ਹੁੰਦੇ ਸੀ ਉਹ ਬੂਥ ਵੀ ਆਪਣੇ ਕੋਲ ਬਣੇ ਪਏ ਨੇ ਉਸੇ ਤਰ੍ਹਾਂ ਹੀ ਟਿੰਡਾਂ ਬਣੀਆਂ ਵੀਆਂ ਨੇ ਖੂਹ ਦੀਆਂ ਅਤੇ ਪੁਰਾਣੇ ਮੰਜੇ ਮੂੰਜੇ ਰੱਖੇ ਨੇ ਪੂਰਾ ਕਲਚਰਲ ਆਉ ਜੀ ਤੁਹਾਨੂੰ ਦੇਖ ਕੇ ਟੱਚ ਆਉਗੀ ਵੀ ਹਾਂ ਵੀ ਪੁਰਾਣਾ ਵਿਆਹ ਹੈ ਫੁਲਕਾਰੀਆਂ ਵਗੈਰਾ ਉਸੇ ਤਰ੍ਹਾਂ ਸਭ ਕੁਝ ਜੀ ਕਿਸ ਤਰੀਕ ਦਾ ਜੀ ਆਪਣਾ ਪ੍ਰੋਗਰਾਮ ਫਿਰ ਮੈਂ ਦੇਖਣਾ ਥੋੜ੍ਹਾ ਜਿਹਾ ਡੇਟ ਥੋੜ੍ਹਾ ਜਿਹਾ ਹੈਗਾ ਅਠਾਰਾਂ ਅਕਤੂਬਰ ਇੱਕ ਮਿੰਟ ਜੀ ਮੈਂ ਚੈੱਕ ਪ੍ਰੀ ਵੈਡਿੰਗ ਦੇਖੋ ਜੀ ਜਾਂ ਤਾਂ ਤੁਸੀਂ ਰੱਖ ਲਓ ਚੌਦਾਂ ਦੀ ਜਾਂ ਸਾਡੇ ਕੋਲ ਵਿਹਲੀ ਆ ਡੇਟ ਜੀ ਸੋਲਾਂ ਦੀ ਬਸ ਦੋ ਡੇਟਾਂ ਵਿਹਲੀਆਂ ਨੇ ਮੈਂ ਤਾਂ ਕਿਹਾ ਜੀ ਪਹਿਲਾਂ ਗੱਲ ਕਰ ਲਵਾਂ ਜੀ ਤੁਹਾਡੇ ਨਾਲ ਚੌ ਚੌਦਾਂ ਰੱਖ ਲਓ ਜੀ

ਫੀਸ ਦੇਖੋ ਜੀ ਆਪਣੀ ਤਾਂ ਲਗਭਗ ਫਿਕਸ ਹੀ ਹੈ ਵੀ ਪੰਜਾਹ ਕੁ ਹਜ਼ਾਰ ਤੋਂ ਅਸੀਂ ਲੈਂਦੇ ਹਾਂ ਉਸ ਤੋਂ ਅੱਗੇ ਬਾਕੀ ਕੁਆਲਿਟੀ 'ਤੇ ਡਿਪੈਂਡ ਕਰਦਾ ਤੁਸੀਂ ਕਿਸ ਤਰ੍ਹਾਂ ਦੀ ਬਣਵਾਉਣੀ ਆ ਉਹ ਕਿਉਂਕਿ ਸਾਈਜ਼ ਦੀਆਂ ਫੋਟੋਆਂ ਵਗੈਰਾ ਵੀ ਬਣ ਜਾਂਦੇ ਨੇ ਵੱਡੇ ਸਾਈਜ਼ ਦੀਆਂ ਅਤੇ ਵੀਡੀਓ ਹੋ ਜਾਂਦੀ ਹੈ ਐਲਬਮ ਹੋ ਜਾਂਦੀ ਹੈ ਉਹ ਬਾਕੀ ਤੁਹਾਨੂੰ ਆ ਕੇ ਪਤਾ ਲੱਗੁ ਜੀ ਤੁਹਾਨੂੰ ਕੁਆਲਿਟੀ ਦਿਖਾ ਦਿਆਂਗੇ ਜਿਸ ਤਰ੍ਹਾਂ ਦੇ ਤੁਸੀਂ ਸਲੈਕਟ ਕਰੋਗੇ ਯਾਨੀ ਮਿਨੀਮਮ ਪੰਜਾਹ ਹਜ਼ਾਰ ਹੈ ਵਧੀਆ ਤੁਸੀਂ ਐਂ ਲਾ ਲਓ ਸੱਤਰ ਪੰਝੱਤਰ ਹਜ਼ਾਰ ਇਹਦੇ ਵਿੱਚ ਵਿੱਚ ਤੁਹਾਡਾ ਕੰਪਲੀਟ ਹੋ ਜਾਣਾ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਭ ਕੁਝ ਵਿੱਚ ਹੀ ਆ ਜਾਣਾ ਜੀ ਬਿਲਕੁਲ ਬਿਲਕੁਲ ਜਿੰਨੇ ਤੁਸੀਂ ਜਿਸ ਚੀਜ਼ 'ਤੇ ਵੀ ਫੋਟੋਗਰਾਫੀ ਕਰਾਉਣੇ ਆਪਣੇ ਕੋਲ ਕਲਾਕਾਰ ਪੂਰੇ ਤਕੜੇ ਨੇ ਜੀ ਜਿਸ ਚੀਜ਼ 'ਤੇ ਵੀ ਤੁਸੀਂ ਫੋਟੋਗ੍ਰਾਫੀ ਡਿਜ਼ਾਇਨ ਕਰਵਾਉਣੀ ਤੁਹਾਨੂੰ ਵਧੀਆ ਅੱਛਾ ਡਿਜਾਇਨ ਕਰ ਕੇ ਦੇਣਗੇ ਜੀ ਹਾਂਜੀ ਹਾਂ ਤੁਸੀਂ ਵਿਜ਼ਿਟ ਕਰ ਕੇ ਜਾਇਓ ਜ਼ਰੂਰ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਆਪਾਂ ਰੇਟ ਵਗੈਰਾ ਵੀ ਕਰ ਲਾਂਗੇ ਚਲੋ ਤੁਸੀਂ ਪਹਿਲੀ ਵਾਰ ਆਏ ਹੋ ਠੀਕ ਹੈ ਸਰ ਫੋਨ ਕਰ ਕੇ ਆਇਓ ਜ਼ਰੂਰ ਹੈ ਜੀ ਠੀਕ ਹੈ ਜੀ ਠੀਕ ਓਕੇ ਜੀ ਓਕੇ